ਮੈਂ ਜਦੋਂ ਛੋਟੀ ਸੀ ਉਦੋਂ ਮੈਂ ਫਲ ਸਬਜ਼ੀਆਂ ਉਗਾਉਣ ਦੀ ਬਹੁਤ ਕੋਸ਼ਿਸ਼ ਕੀਤੀ ਸੀ ਮੇਰੇ ਨਾਲ ਨਾਲ ਜਿਹਦਾ ਖੇਤ ਸੀਗਾ ਅਤੇ ਉਹ ਵੱਖ ਵੱਖ ਤਰ੍ਹਾਂ ਦੀਆਂ ਸਬਜ਼ੀਆਂ ਅਤੇ ਫਲ ਉਗਾਉਂਦੇ ਸਨ ਹੁਣ ਮੈਨੂੰ ਵੀ ਉਦੋਂ ਬਹੁਤ ਸ਼ੌਂਕ ਸੀਗਾ ਵੀ ਮੈਂ ਵੀ ਨਾਨਾ ਜੀ ਦੀ ਮਦਦ ਕਰਾਂ ਜਾ ਕੇ ਅਤੇ ਵੇਖਾਂ ਵੀ ਇਹ ਸਭ ਕਿੱਦਾਂ ਹੁੰਦਾ ਅਤੇ ਕਿੱਦਾਂ ਉਗਾਈ ਜਾਂਦੀ ਹੈ ਤਾਂ ਮੈਂ ਉਦੋਂ ਨਾਨਾ ਜੀ ਦੀ ਮਦਦ ਕਰਨ ਗਈ ਸੀ ਅਸੀਂ ਕਰੇਲੇ ਭਿੰਡੀਆਂ ਅਤੇ ਟਮਾਟਰ ਮਿਰਚਾਂ ਵਾਧੂ ਤਰ੍ਹਾਂ ਦੀਆਂ ਸਬਜ਼ੀਆਂ ਉਗਾਈਆਂ ਅਤੇ ਫਲਾਂ ਵਿੱਚ ਸੇਬ ਵੀ ਉਗਾਏ ਅਤੇ ਇਸ ਵਜ੍ਹਾ ਨਾਲ ਮੈਨੂੰ ਪਤਾ ਲੱਗਾ ਕਿ ਸਾਨੂੰ ਚੰਗੀ ਤਰ੍ਹਾਂ ਫਸਲ ਸਫ ਜਿਹੜੀ ਫਸਲ ਹੈਗੀ ਆ ਉਹ ਉਗਾਉਣੀ ਚਾਹੀਦੀ ਹੈ ਚੰਗੀ ਤਰ੍ਹਾਂ ਉਹਨੂੰ ਚੰਗੀ ਮਾਤਰਾ ਦੇ ਵਿੱਚ ਪਾਣੀ ਅਤੇ ਸੂਰਜ ਦੀ ਜਿਹੜੀ ਰੋਸ਼ਨੀ ਹੈ ਉਹ ਦੇਣੀ ਚਾਹੀਦੀ ਹੈ ਫਿਰ ਹੀ ਉਹ ਉੱਗਦੇ ਹਨ ਜੇਕਰ ਉਹਨਾਂ ਨੂੰ ਪਾਣੀ ਨਹੀਂ ਚੰਗੀ ਤਰ੍ਹਾਂ ਦਿੱਤਾ ਜਾਵੇਗਾ ਤਾਂ ਉਹ ਮੁਰਝਾ ਜਾਣਗੇ ਅਤੇ ਉਹ ਸੜ ਜਾਣਗੇ ਆਪਾਂ ਨੂੰ ਉਹਨਾਂ ਦੀ ਚੰਗੀ ਤਰ੍ਹਾਂ ਦੇਖਭਾਲ ਕਰਨੀ ਚਾਹੀਦੀ ਹੈ ਫਿਰ ਹੀ ਉਹ ਇੱਕ ਬਹੁਤ ਚੰਗਾ ਫਲ ਬਣੇਗਾ